ਪੰਜਾਬ ਦੀ ਪਰੰਪਰਾਗਤ ਕਲਾ ਜਿਵੇਂ ਕਿ ਤਰਖਾਣ ਦਾ ਕੰਮ ਸੁਨਿਆਰੇ ਦਾ ਕੰਮ ਘੁਮਿਆਰ ਦਾ ਕੰਮ ਜਾਂ ਪੱਥਰ 'ਤੇ ਕਿਸੇ ਵੀ ਤਸਵੀਰ ਨੂੰ ਉਕੇਰਨਾ ਇਹ ਪੀੜ੍ਹੀ ਦਰ ਪੀੜ੍ਹੀ ਨਾਲ਼ ਹੀ ਜੁੜੀਆਂ ਹਨ ਕਿਸੇ ਨੇ ਜੇ ਜੁੱਤੀ ਦਾ ਕੋਈ ਕੰਮ ਕਰਦਾ ਉਸਦੇ ਉੱਤੇ ਕੋਈ ਡਿਜ਼ਾਇਨ ਉਕੇਰਦਾ ਇਹ ਵੀ ਪੀੜ੍ਹੀ ਦਰ ਪੀੜ੍ਹੀ ਨਾਲ਼ ਹੀ ਜ਼ੁ ਜੁੜਿਆ ਹੋਇਆ ਹੈ ਅਤੇ ਇਸ ਦੇ ਨਾਲ਼ ਕੀ ਹੈ ਉਹਨਾਂ ਦੀ ਪੀੜ੍ਹੀਆਂ ਤੋਂ ਇਹ ਕੰਮ ਚੱਲਦਾ ਆ ਰਿਹਾ ਉਹ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਅੱਗੇ ਕਰਦੇ ਨੇ ਉਹਨਾਂ ਦੇ ਬੱਚੇ ਅੱਗੇ ਕਰਦੇ ਨੇ ਇਸ ਨੂੰ ਆਪਾਂ ਕਹਿ ਸਕਦੇ ਆ ਪੀੜ੍ਹੀ ਦਰ ਪੀੜ੍ਹੀ ਨਾਲ਼ ਜੁੜਿਆ ਜਿਹਦੇ ਨਾਲ਼ ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਚਲਾਉਣ ਵਿੱਚ ਉਹਨਾਂ ਨੂੰ ਮਦਦ ਮਿਲਦੀ ਹੈ